ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਭਾਅ ਜੀ ਮੈਂ ਤੁਹਾਨੂੰ ਸਵੀਗੀ ਤੋਂ ਇੱਕ ਪਲੇਟ ਪਨੀਰ ਦੀ ਸਬਜ਼ੀ ਦਾ ਆਡਰ ਕੀਤਾ ਹੈ ਮੇਰਾ ਘਰ ਤੁਹਾਨੂੰ ਜੇ ਲੱਭਣ ਦੇ ਵਿੱਚ ਪਰੇਸ਼ਾਨੀ ਹੋ ਰਹੀ ਹੈ ਤਾਂ ਮੈਂ ਤੁਹਾਡੀ ਪਰੇਸ਼ਾਨੀ ਦਾ ਸਮਾਧਾਨ ਕਰਨ ਲਈ ਤੁਹਾਨੂੰ ਇੱਕ ਸਿੱਧਾ ਸਿੱਧਾ ਰਸਤਾ ਦੱਸਦੀ ਹਾਂ ਤੁਸੀਂ ਕੁਝ ਨਹੀਂ ਕਰਨਾ ਜ਼ਿਆਦਾ ਕੁਝ ਨਹੀਂ ਕਰਨਾ ਤੁਸੀਂ ਸਿਰਫ਼ ਮੇਰੇ ਘਰ ਦੇ ਸਹੀ ਟਿਕਾਣੇ ਵੱਲ ਪਹੁੰਚਣ ਲਈ ਤੁਹਾਨੂੰ ਸਭ ਤੋਂ ਪਹਿਲੇ ਉਸੇ ਦਿਸ਼ਾ ਦੇ ਵੱਲ ਜਾਂਦੇ ਹੋਏ ਬਾਬਾ ਬੁੱਢਾ ਸਿੰਘ ਪਾਰਕ ਮਿਲੇਗਾ ਉਸ ਦੇ ਸਿੱਧੇ ਵਾਲੀ ਸਾਹਮਣੇ ਵਾਲੀ ਗਲੀ ਦੇ ਵਿੱਚ ਤੁਹਾਨੂੰ ਇੱਕ ਕਰਿਆਨੇ ਦੀ ਦੁਕਾਨ ਮਿਲੇਗੀ ਜਿਸ ਦਾ ਨਾਮ ਵੀਰੇ ਦੀ ਹੱਟੀ ਹੈ ਉੱਥੇ ਉੱਧਰੋਂ ਦੀ ਤੁਸੀਂ ਸੱਜੀ ਗਲੀ ਵੱਲ ਮੁੜਨਾ ਹੈ ਅਤੇ ਮੁੜ ਕੇ ਤੁਸੀਂ ਮੈਨੂੰ ਫੋਨ ਕਰ ਦਈਓ ਅਤੇ ਮੈਂ ਤੁਹਾਨੂੰ ਫਿਰ ਉਸ ਤੋਂ ਬਾਅਦ ਫੋਨ ਰਾਹੀਂ ਸਾਰੀ ਗੱਲਬਾਤ ਦੱਸਾਂਗੀ